ਮੇਰਾ ਨਾਮ ਮੋਨਿਕਾ ਰਾਣੀ ਹੈ ਮੈਂ ਪਿੰਡ ਰੈਲਮਾਜਰੇ ਵਿੱਚ ਰਹਿੰਦੀ ਹਾਂ ਅੱਜ ਸਾਡੇ ਘਰ ਅਚਾਨਕ ਗੈਸਟ ਆ ਗਏ ਹਨ ਇਸ ਕਰਕੇ ਮੈਂ ਇੰਨੀ ਜਲਦੀ ਖਾਣਾ ਨਹੀਂ ਬਣਾ ਸਕਦੀ ਮੈਂ ਆਪਣੇ ਬ੍ਰਦਰ ਨੂੰ ਕਿਹਾ ਸਾਡੇ ਪਿੰਡ ਵਿੱਚ ਇੱਕ ਪ੍ਰੀਤ ਢਾਬਾ ਹੈ ਤੂੰ ਉੱਥੇ ਜਾ ਕੇ ਸ਼ਾਹੀ ਪਨੀਰ ਦਾਲ ਮੱਖਣੀ ਮਟਰ ਪਨੀਰ ਅਤੇ ਰੋਟੀ ਲੈ ਆ ਅਤੇ ਉਹਨਾਂ ਨੂੰ ਕਹੀਂ ਖਾਣੇ ਦੇ ਵਿੱਚ ਨਮਕ ਨਾ ਜ਼ਿਆਦਾ ਹੋਵੇ ਅਤੇ ਨਾ ਘੱਟ ਮਸਾਲੇ ਵੀ ਥੋੜ੍ਹੇ ਘੱਟ ਹੀ ਰੱਖੇ ਜਾਣ ਅਤੇ ਨਾਲ ਇਕ ਸਵੀਟ ਮਤਲਬ ਮਿੱਠਾ ਕੁਛ ਖਾਣ ਨੂੰ ਲੈ ਆਈ ਕਿਉਂਕਿ ਅਸ ਉਹ ਸਾਰੇ ਖਾਣੇ ਤੋਂ ਬਾਅਦ ਕੁਛ ਮਿੱਠਾ ਖਾਣਾ ਪਸੰਦ ਕਰਦੇ ਹਨ ਉਸ ਵਿੱਚ ਵੀ ਥੋੜ੍ਹਾ ਜਿਹਾ ਮਿੱਠਾ ਘੱਟ ਹੋਈ ਹੋਵੇ ਨਾ ਜ਼ਿਆਦਾ ਹੋਵੇ ਸਾਨੂੰ ਖਾਣਾ ਵਧੀਆ ਚਾਹੀਦਾ ਹੈ ਅਤੇ ਸਾਡੇ ਗੈਸਟਾਂ ਨੇ ਜਲਦੀ ਜਲਦੀ ਆਪਣੇ ਘਰ ਪਹੁੰਚਣਾ ਹੈ ਅਤੇ ਸਾਨੂੰ ਖਾਣਾ ਜਲਦੀ ਤੋਂ ਜਲਦੀ ਪਹੁੰਚਾਇਆ ਜਾਵੇ